ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸੁਰੱਖਿਅਤ ਰਹਿਣ ਦੇ ਕੁਝ ਤਰੀਕੇ ਹਨ ਜੋ ਕਿ ਕਿਸ਼ਤੀ ਅਤੇ ਟਿਊਬ ਟਰੱਕ ਟਿਊਬ ਅਤੇ ਹੋਰ ਵੀ ਕਈ ਤਰ੍ਹਾਂ ਦੇ ਸਾਧਨ ਆਪਾਂ ਨੂੰ ਰੱਖਣੇ ਚਾਹੀਦੇ ਹਨ ਅਤੇ ਆਪਾਂ ਇਸ ਨੂੰ ਪਾਣੀ ਦੇ ਨਾਲ ਧੱਕਾ ਨਹੀਂ ਕੀਤਾ ਜਾਵੇਗਾ